ਪਰੰਪਰਾਗਤ ਮੌਕਿਆਂ 'ਤੇ ਨੱਚਦੇ ਸਮੇਂ ਲੋਕ ਆਪਣੇ ਪਰੰਪਰਾਗਤ ਕੱਪੜੇ ਪਹਿਨਦੇ ਹਨ ਜਿਵੇਂ ਆਪਾਂ ਮੁੰਡਿਆਂ ਦੀ ਗੱਲ ਕਰੀਏ ਤਾਂ ਉਹ ਧੋਤੀ ਕੁੜਤਾ ਪਜਾਮਾ ਜਾਂ ਅ ਅਤੇ ਪੱਗ ਇਹ ਸਭ ਚੀਜ਼ਾਂ ਪਾਉਂਦੇ ਹਨ ਜਿਸ ਨਾਲ ਉਹ ਪੰਜਾਬ ਦੇ ਗੱਭਰੂ ਜਵਾਨ ਲੱਗਦੇ ਹਨ ਜੇ ਆਪਾਂ ਕੁੜੀਆਂ ਦੀ ਗੱਲ ਕਰੀਏ ਤਾਂ ਉਹ ਸਲਵਾਰ ਸੂਟ ਨਾਲ ਫੁਲਕਾਰੀ ਲੈਂਦੀਆਂ ਹਨ ਅਤੇ ਨਾਲ ਪਰਾਂਦਾ ਵੀ ਪਾਉਂਦੀਆਂ ਹਨ ਗਹਿਣਿਆਂ ਦੇ ਵਿੱਚ ਮੁੰਡੇ ਆਪਣਾ ਗਲੇ ਵਿੱਚ ਕੈਂਠਾ ਆਪਣੇ ਬਾਜੂ ਵਿੱਚ ਬਾਜੂ ਬੰਦ ਹੋਰ ਵੀ ਆਪਣੇ ਹੱਥ ਵਿੱਚ ਖ ਖੁੰਡੀ ਆਪਣੇ ਉਹ ਨੱਚਣ ਦੇ ਸਮੇਂ ਔਰ ਆਪਾਂ ਸੱਪ ਦੀ ਵਰਤੋਂ ਕਰਦੇ ਹਨ ਆਪਣੇ ਪੱਗ ਦੇ ਉੱਤੇ ਕਲਗੀ ਦੀ ਵਰਤੋਂ ਕਰਦੇ ਹਨ ਕੁੜੀਆਂ ਗਹਿਣਿਆਂ ਦੀ ਵਰਤੋਂ ਕਰਦੀਆਂ ਹਨ ਜਿਹਦੇ ਵਿੱਚ ਟਿੱਕਾ ਝੁਮਕੇ ਗਲੇ ਦਾ ਹਾਰ ਚੂੜੀਆਂ ਪਾਇਲ ਅਤੇ ਪੰਜਾਬੀ ਜੁੱਤੀ ਪਹਿਨਦੀਆਂ ਹਨ ਅਤੇ ਮੁੰਡੇ ਵੀ ਤਿੱਲੇ ਵਾਲੀ ਜੁੱਤੀ ਪਹਿਨਦੇ ਹਨ ਜਿਸ ਨਾਲ ਉਹ ਬਹੁਤ ਹੀ ਸੋਹਣੇ ਲੱ ਸੋਹਣੇ ਗੱਭਰੂ ਜਵਾਨ ਲੱਗਦੇ ਹਨ ਅਤੇ ਹੋਰ ਵੀ ਬਹੁਤ ਕੁਛ ਹੁੰਦਾ ਹੈ ਇਸ ਤੋਂ ਬਾਅਦ ਅੱਗੇ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਪ੍ਰੰਪਰਾਗਤ ਮੌਕੇ ਜਿਵੇਂ ਕੋਈ ਟਰੈਡੀਸ਼ਨਲ ਜਾਂ ਆਪਣਾ ਕੋਈ ਲੋਕ ਗੀਤ ਹੁੰਦੇ ਆ ਵਾ ਆਪ ਆਪਣਾ ਭੰਗੜੇ ਆ ਭੰਗੜਾ ਪਾਉਣਾ ਅਤੇ ਆਪਾਂ ਭੰਗੜੇ ਦਾ ਡਰੈਸ ਕੋਟ ਡਰੈਸਅਪ ਹੁੰਦਾ ਵਾ ਸੂਟ ਸਲਵਾਰ ਜਾਂ ਸਾਡੇ ਮ ਮੁੰਡਿਆਂ ਦੀ ਹੋ ਗਿਆ ਧੋਤੀ ਅਤੇ ਕੁੜਤਾ ਅਤੇ ਉਸ ਦੀ ਵਰਤੋਂ ਕਰਕੇ ਹੋਰ ਬਹੁਤ ਹੀ ਸੋਹਣੇ ਲੱਗਦੇ ਹਨ ਜੋ ਕਿ ਸਾਡਾ ਪੁਰਾਣਾ ਇਤਿਹਾਸ ਦਿਖਾਉਂਦਾ ਹੈ ਜਾਂ ਸਾਡੀ ਇਤਿਹਾਸਿਕ ਇਤਿਹਾਸਿਕ ਨ ਇਤਿਹਾਸਿਕ ਪਹਿਰਾਵਾ ਹੈ ਜੋ ਕਿ ਜੋ ਕਿ ਮੁੱਢਲੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ ਸਾਡੇ ਦਾਦਾ ਪੜਦਾਦਾ ਇਸੇ ਤਰ੍ਹਾਂ ਦੇ ਪਹਿਰਾਵੇ ਦੀ ਵਰਤੋਂ ਕਰਦੇ ਸਨ ਜੋ ਕਿ ਹੁਣ ਸਿਰਫ਼ ਇੱਕ ਲੋਕ ਨਾਚ ਦੇ ਵਿੱਚ ਹੀ ਦੇਖਿਆ ਜਾ ਸਕਦਾ ਹੈ ਆਮ ਤੌਰ 'ਤੇ ਲੋਕਾਂ ਨੇ ਇਸ ਪਹਿਰਾਵੇ ਨੂੰ ਪਾਉਣਾ ਜਾ ਹ ਵਰਤੋਂ ਵਿੱਚ ਲਿਆਉਣਾ ਬੰਦ ਹੀ ਕਰ ਦਿੱਤਾ ਹੈ ਪਰ ਜਿੱਥੇ ਵੀ ਅਸੀਂ ਇਸ ਪਹਿਰਾਵੇ ਨੂੰ ਦੇਖਦੇ ਹਾਂ ਤਾਂ ਮਨ ਬਹੁਤ ਖੁਸ਼ ਹੁੰਦਾ ਹੈ ਜਿੱਥੇ ਔਰਤਾਂ ਸਿਰ 'ਤੇ ਫੁਲਕਾਰੀ ਲੈ ਕੇ ਗੁੱਤ 'ਚ ਪਰਾਂਦਾ ਪਾ ਕੇ ਅਤੇ ਆਪਣੇ ਹੱਥ ਵਿੱਚ 'ਚ ਹ ਕਣਕ ਛਾਣਦੇ ਹਨ ਜਾਂ ਉਨ ਜਾਂ ਉਨ ਕੱਟਦੇ ਹਨ ਜਾਂ ਸਾਗ ਨੂੰ ਘੋਟਦੇ ਹਨ ਤਾਂ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਜੋ ਕਿ ਸਾਡਾ ਪਰਾ ਪੰਜਾਬੀ ਇੱਕ ਟ੍ਰਡੀਸ਼ਨਲ ਦਿਖਾ ਰੈਬਿਟ ਟ੍ਰਡੀਸ਼ਨਲ ਦਾ ਇੱਕ ਕਿਸੇ ਚਿੱਤਰ ਦਾ ਵਰਣਨ ਕਰਦੇ ਹਨ ਇਹ ਦੇਖ ਕੇ ਮਨ ਬਹੁਤ ਹੀ ਪ੍ਰਭਾਵਿਤ ਹੁੰਦਾ ਹੈ ਧੰਨਵਾਦ